ਖੇਡਾਂ ਸਟੇਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਪੇਂਡੂ ਖੇਤਰ ਦੇ ਲੋਕਾਂ ਦੇ ਵਿੱਚ ਬਹੁਤ ਚੰਗਾ ਪ੍ਰਭਾਵ ਪਾ ਰਹੀਆਂ ਹਨ ਅੱਜ ਪਿੰਡਾਂ ਦੇ ਲੋਕ ਜਾਂ ਪੇਂਡੂ ਖੇਤਰੀ ਲੋਕ ਵੀ ਖੇਡਾਂ ਵੱਲ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਰਹੇ ਨੇ ਇਹ ਦੇਖ ਕੇ ਕਿ ਗੇਮ ਦੇ ਸਿਰ 'ਤੇ ਗੌਰਮੈਂਟ ਜੋਬ ਜਾਂ ਹੋਰ ਬਹੁਤ ਹੀ ਓਪਰਚੁੰਨਟੀਸ ਆ ਰਹੀਆਂ ਨੇ ਐਡ ਹੋ ਗਈ ਉਸ ਤੋਂ ਇਲਾਵਾ ਵਧੀਆ ਵਧੀਆ ਅਹੁਦਿਆਂ 'ਤੇ ਅੱਜ ਕੱਲ੍ਹ ਖਿਡਾਰੀ ਬੈਠੇ ਨੇ ਜਿਵੇਂ ਕਿ ਹਰਭਜਨ ਸਿੰਘ ਇੱਕ ਕ੍ਰਿਕਟਰ ਹੈ ਉਹ ਪੰਜਾਬ ਦੇ ਵਿੱਚ ਬਤੌਰ ਡੀਐੱਸਪੀ ਦੀ ਡਿਊਟੀ ਵੀ ਕਰ ਰਿਹਾ ਹੈ ਔਰ ਪਿੰਡਾਂ ਦੇ ਲੈਵਲ ਦੇ ਕਾਫ਼ੀ ਖਿਡਾਰੀ ਅੱਜ ਨੈਸ਼ਨਲ ਗੇਮਸ ਦੇ ਵਿੱਚ ਕ੍ਰਿਕਟ ਦੇ ਵਿੱਚ ਜਿਵੇਂ ਰਿੰਕੂ ਸਿੰਘ ਬਹੁਤ ਹੀ ਵਧੀਆ ਪਰਫੋਰਮੈਂਸ ਦਿਖਾ ਰਿਹਾ ਹੈ ਇੰਡੀਅਨ ਕ੍ਰਿਕਟ ਦੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਇੱਕ ਵਧੀਆ ਪਲੇਅਰ ਦੇ ਤੌਰ 'ਤੇ ਉੱਭਰ ਰਿਹਾ ਸਿਤਾਰਾ ਹੈ